ਸਾਈਕਲ ਚਲਾਉਣ ਵੇਲੇ ਪਹਿਲੀ ਗੱਲ ਤਾਂ ਇਹ ਹੈ ਵੀ ਆਪਾਂ ਆਪ ਆਪਣੇ ਹਿਸਾਬ ਨਾਲ਼ ਇਹ ਸਾਈਕਲ ਚਲਾਓ ਕਿਉਂ ਅੱਜ ਕੱਲ੍ਹ ਲੋਕ ਬਹੁਤ ਤੇਜ਼ ਸਪੀਡ ਨਾਲ਼ ਆਉਂਦੇ ਆ ਸਾਈਕਲ ਵਾਲੀ ਪਰਵਾਹ ਨਹੀਂ ਕਰਦੇ ਨੰਬਰ ਦੋ 'ਤੇ ਜੇ ਬੱਚਿਆਂ ਨੂੰ ਵੀ ਸਾਈਕਲ ਦੇਣਾ ਤਾਂ ਉਹਦੇ ਬਹੁਤੀ ਦੂਰ ਨਾ ਭੇਜੋ ਅਪ ਆਪ ਨਾਲ ਰਹੋ ਨੰਬਰ ਤਿੰਨ ਇਹ ਹੈ ਵੀ ਸਾਈਕਲ ਚਲਾਉਣ ਜਾਂ ਸੈਰ ਕਰਨੀ ਆ ਉਹ ਟਾਈਮ ਸਾਡੇ ਕੋਲ਼ ਜੋ ਵੀ ਦਸਤਾਵੇਜ਼ ਹੈ ਜਿਵੇਂ ਆਧਾਰ ਕਾਰਡ ਰਿਟਾਇਰਮੈਂਟ ਆਈ ਕਾਰਡ ਅਤੇ ਹੋਰ ਜ਼ਰੂਰੀ ਕਾਗਜ਼ਾਤ ਕੋਈ ਜੇਬ ਦੇ ਵਿੱਚ ਹੋਣਾ ਬਹੁਤ ਜ਼ਰੂਰੀ ਹੈ ਰੱਬ ਨਾ ਕਰੇ ਕੱਲ੍ਹ ਨੂੰ ਕੋਈ ਘਟਨਾ ਹੋ ਜਾਵੇ ਤਾਂ ਦੂਜੇ ਬੰਦੇ ਨੂੰ ਉਹਦੇ ਐਡਰੈਸ ਬਾਰੇ ਕੁਝ ਪਤਾ ਲੱਗ ਜਾਵੇ ਅਤੇ ਬਾਕੀ ਸੈਰ ਹੈ ਜਿਹੜੀ ਇਹ ਸੈਰ ਤਾਂ ਜਰੂਰੀ ਹੈ ਪਰ ਸੈਰ ਜੇ ਆਪਾਂ ਸੜਕਾਂ 'ਤੇ ਕਰੂਂਗੇ ਤਾਂ ਅਸੀਂ ਧੋਖਾ ਖਾਓਗੇ ਸੈਰ ਕਦੇ ਪਾਰਕ ਵਗੈਰਾ ਦੇ ਵਿੱਚ ਹੀ ਕਰ ਲੈਣੀ ਚਾਹੀਦੀ ਆ